ਸਾਡੇ ਦੇਸ਼ ਵਿੱਚ ਬਹੁ ਬਹੁਤ ਸਾਰੇ ਖੇਡ ਖੇਡੇ ਜਾਂਦੇ ਨੇ ਪਰ ਸਭ ਤੋਂ ਲੋਕਪ੍ਰਿਯ ਜਿਹੜਾ ਖੇਡ ਹੈ ਉਹ ਕ੍ਰਿਕਟ ਹੈ ਆਪਣੇ ਅਤੇ ਇਹ ਮੇਰਾ ਮਨਪਸੰਦ ਮਨਪਸੰਦ ਖੇਡ ਹੈ ਅਤੇ ਇਹ ਇ ਇਹ 'ਚ ਕਈ ਤਰ੍ਹਾਂ ਦੇ ਲੋ ਲੋਕਪ੍ਰਿਯ ਖਿਡਾਰੀ ਵੀ ਹਨ ਜ ਜਿਹੜੇ ਆਪਣੇ ਪੂਰੇ ਅੰਤਰਰਾਸ਼ਟਰੀ ਸ ਸਤਰ ਵਿੱਚ ਵ ਵ ਮਸ਼ਹੂਰ ਹਨ ਜਿੱਦਾਂ ਕਿ ਵਿਰਾਟ ਕੋਹਲੀ ਸਚਿਨ ਤੇਂਦੁਲਕਰ ਅਤੇ ਐੱਮ ਐੱਸ ਧੋਨੀ ਅਤੇ ਮੇਰਾ ਫੇਵਰਟ ਪਲੇਅਰ ਕ੍ਰਿ ਵਿਰਾਟ ਕੋਹਲੀ ਹੈ ਜਿਸ ਕਰਕੇ ਮੈਂ ਇਹ ਗੇਮ ਖੇਡਦਾ ਹਾਂ ਕਿਉਂਕਿ ਮੈਨੂੰ ਉਹ ਪ੍ਰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਅਤੇ ਇਸ ਇਸ ਖੇਡ ਨੂੰ ਮੈਂ ਵੱਡੇ ਗਰਾਊਂਡ 'ਚ 'ਤੇ ਖੇਡਦਾ ਹਾਂ ਜਿਸ ਵਿੱਚ ਕੁੱਲ ਇਹ ਇਹ ਗਿਆਰ੍ਹਾਂ ਖਿਡਾਰੀ ਹੁੰਦੇ ਹਨ ਇਹ ਇੱਕ ਟੀਮ 'ਚ ਅਤੇ ਟੋਟਲ ਬਾਈ ਬਾਈ ਜਣੇ ਹੁੰਦੇ ਹਨ ਅਤੇ ਇਹ ਇਹ ਜਿਹੜੇ ਖੇਡ ਹੈ ਇਹ ਪੂਰੇ ਗਰਾਊਂਡ 'ਚ ਖੇਲੀ ਜਾਂਦੀ ਹੈ ਜਿਸ ਵਿੱਚ ਇੱਕ ਪਿੱਚ ਪਿੱਚ 'ਚ ਬਾਈ ਬਾਈ ਕਦਮ ਬਾਈ ਕਦਮਾਂ ਦੀ ਪਿੱਚ ਹੁੰਦੀ ਹੈ ਅਤੇ ਇਹ ਖੇਡ ਨੂੰ ਬੈਟ ਅਤੇ ਬੱਲੇ ਨਾਲ ਖੇਡਿਆ ਜਾਂਦਾ ਹੈ ਅਤੇ ਇਹ ਜਿਹੜੀ ਇ ਇਹ ਜਿਹੜੀ ਖੇਡ ਹੈ ਇਹ ਪੂਰੇ ਅੰਤਰਰਾਸ਼ਟਰੀ ਸਤਰ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਅਤੇ ਇਹ ਆਪਣਾ ਜਿਹੜਾ ਕਿਉਂਕਿ ਸਾਡਾ ਇੰਡੀਆ ਹੈ ਇਹ 'ਚ ਬਹੁਤ ਵਧੀਆ ਰੈਂਕ ਹੈ